ਜੇਕਰ ਮੈਂ ਪਕਵਾਨਾਂ ਦੀ ਗੱਲ ਕਰਾਂ ਤਾਂ ਮੈਨੂੰ ਪਕਵਾਨ ਬਣਾਉਣ 'ਚ ਬਹੁਤ ਦਿਲਚਸਪੀ ਹੈ ਮੈਂ ਅਲੱਗ ਅਲੱਗ ਤਰ੍ਹਾਂ ਦੇ ਪਕਵਾਨ ਬਣਾਉਂਦੀ ਹਾਂ ਮੇਰੇ ਘਰ ਵਿੱਚ ਮੇਰੇ ਸਾਰੀ ਹੀ ਫੈਮਿਲੀ ਮੈਂਬਰਸ ਨੂੰ ਮੇਰੇ ਹੱਥ ਦੇ ਬਣੇ ਹੋਏ ਪਕਵਾਨ ਬਹੁਤ ਪਸੰਦ ਆਉਂਦੇ ਨੇ ਜਿੰਨਾਂ ਵਿੱਚ ਮੈਂ ਖਾਸ ਤੌਰ 'ਤੇ ਗੱਲ ਕਰਾਂ ਤਾਂ ਮਿਕਸ ਪਕੌੜੇ ਜਾਂ ਅਲੱਗ ਅਲੱਗ ਤਰ੍ਹਾਂ ਦੇ ਪਕੌੜੇ ਪਕੌੜੇ ਬਣਾਉਣ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਹਮੇਸ਼ਾਂ ਤੋਂ ਹੀ ਜਦ ਵੀ ਮੇਰੀ ਫੈਮਿਲੀ ਕਹਿੰਦੀ ਕੁਛ ਖਾਣ ਨੂੰ ਦਿਲ ਕਰਦਾ ਤਾਂ ਮੈਂ ਅਲੱਗ ਅਲੱਗ ਤਰ੍ਹਾਂ ਦੇ ਪਕੌੜੇ ਬਣਾ ਕੇ ਉਹਨਾਂ ਨੂੰ ਖਵਾਉਂਦੀ ਹਾਂ ਜੇਕਰ ਮਿਕਸ ਪਕੌੜਿਆਂ ਦੀ ਗੱਲ ਕਰੀਏ ਤਾਂ ਮੈਂ ਉਹਦੇ ਵਿੱਚ ਸਾਰੀਆਂ ਵੈਜੀਟੇਬਲਸ ਐਡ ਕਰਦੀ ਹਾਂ ਵੇਸਨ ਵਗੈਰਾ ਪਾ ਕੇ ਉਹਨਾਂ 'ਚ ਜਿੰਨੇ ਵੀ ਮਸਾਲੇ ਵਗੈਰਾ ਲੂਣ ਵਗੈਰਾ ਸਭ ਕੁਛ ਪਾ ਕੇ ਉਹਨਾਂ ਨੂੰ ਤਲ ਕੇ ਫਰਾਈ ਕਰਕੇ ਬਣਾਈ ਦਾ ਅਤੇ ਬਹੁਤ ਹੀ ਸਵਾਦਿਸ਼ਟ ਬਣਦੇ ਨੇ ਅ ਆਸਾਨ ਪਕਵਾਨ ਹਰ ਕੋਈ ਹੁੰਦਾ ਏ ਜੇਕਰ ਬੰਦੇ ਦੇ ਹੱਥ 'ਚ ਮਤਲਬ ਪਕਵਾਨ ਨੂੰ ਬਣਾਉਣ ਦੀ ਇੱਛਾ ਜਾਂ ਉਹਦੇ ਦਿਲ 'ਚ ਹੋਵੇ ਹੱਥ 'ਚ ਜਾਦੂ ਹੋਵੇ ਤਾਂ ਹਰ ਪਕਵਾਨ ਨੂੰ ਬਣਾਉਣਾ ਸੌਖਾ ਹੁੰਦਾ ਹੈ ਪਰ ਫਿਰ ਵੀ ਮੈਨੂੰ ਸਭ ਤੋਂ ਜ਼ਿਆਦਾ ਪਕੌੜੇ ਬਣਾਉਣਾ ਅਤੇ ਰੋਟੀ ਬਣਾਉਣਾ ਸਭ ਤੋਂ ਜ਼ਿਆਦਾ ਆਸਾਨ ਅ ਤਰੀਕਾ ਲੱਗਦਾ ਹੈ ਜੇਕਰ ਇਹਨਾਂ 'ਚ ਤਰੀਕੇ ਦੀ ਗੱਲ ਕਰੀਏ ਜੇ ਕੋਈ ਸਬਜ਼ੀ ਬਣਾਉਣ ਦਾ ਤਰੀਕਾ ਸਭ ਤੋਂ ਔਖਾ ਲੱਗਦਾ ਤਾਂ ਉਹ ਹੈ ਸਾਗ ਕਿਉਂਕਿ ਸਾਗ ਇਕ ਤਾਂ ਸਰਦੀਆਂ ਦੀ ਸਬਜ਼ੀ ਕਹਿ ਸਕਦੇ ਹਾਂ ਆਪਾਂ ਨਾ ਇੱਕ ਅਲੱਗ ਡਿਸ਼ ਹੈ ਜਿਹਨੂੰ ਕਿ ਜੋ ਕਿ ਪੰਜਾਬੀਆਂ ਦੀ ਇੱਕ ਬਹੁਤ ਹੀ ਅ ਫੇਮਸ ਰੈਸੀਪੀ ਕਹਿ ਸਕਦੇ ਹਾਂ ਆਪਾਂ ਜਾਂ ਕਿ ਸਬਜ਼ੀ ਕਹਿ ਸਕਦੇ ਹਾਂ ਕਿ ਇੱਕ ਅਲੱਗ ਚੀਜ਼ ਸਿਆਲ 'ਚ ਖਾਣ ਨੂੰ ਮਿਲਦੀ ਹੈ ਸਾਗ ਕਿ ਸਾਗ ਦੇ ਨਾਲ ਮੱਕੀ ਦੀ ਰੋਟੀ ਹਰ ਕੋਈ ਪਸੰਦ ਕਰਦਾ ਪਰ ਸਾਗ ਇੱਕ ਅਜਿਹੀ ਚੀਜ਼ ਹੈ ਜਿਹਨੂੰ ਬਣਾਉਣ 'ਚ ਬਹੁਤ ਸਾਰਾ ਟਾਈਮ ਲੱਗਦਾ ਹੈ ਫਿਰ ਇਹਦੇ ਵਿੱਚ ਇਹ ਹੈ ਕਿ ਜੇਕਰ ਸਾਗ ਚੰਗੀ ਤਰ੍ਹਾਂ ਪੱਕਿਆ ਹੋਵੇ ਪਕਾਇਆ ਗਿਆ ਹੋਵੇ ਤੜਕਾ ਲੱਗਾ ਹੋਵੇ ਫਿਰ ਹੀ ਚੰਗਾ ਲੱਗਦਾ ਹੈ ਨਹੀਂ ਤਾਂ ਸਾਗ ਬਹੁਤ ਜ਼ਿਆਦਾ ਕੱਚਾ ਰਹਿ ਜੇ ਤਾਂ ਔਖਾ ਲੱਗਦਾ ਹੈ ਅਤੇ ਜੇਕਰ ਜੇਕ ਹੋਰ ਸਬਜ਼ੀਆਂ ਦੀ ਗੱਲ ਕਰੀਏ ਤਾਂ ਬਹੁਤ ਆਸਾਨ ਤਰੀਕੇ ਹੁੰਦੇ ਨੇ ਉਹਨਾਂ ਨੂੰ ਬਣਾਉਣ ਦੇ ਅਤੇ ਫਿਰ ਵੀ ਜੇਕਰ ਮੈਂ ਆਪਣੇ ਐਕਸਪੀਰੀਅੰਸ ਦੀ ਗੱਲ ਕਰਾਂ ਤਾਂ ਮੈਨੂੰ ਹਰ ਸਬਜ਼ੀ ਬਣਾਉਣੀ ਸੌਖੀ ਲੱਗਦੀ ਹੈ ਕਿ ਸਾਗ ਬਣਾਉਣਾ ਥੋੜ੍ਹਾ ਔਖਾ ਲੱਗਦਾ ਹੈ ਅਤੇ ਸਾਗ ਟਾਈਮ ਵੀ ਬਹੁਤ ਲੈਂਦਾ ਇਸ ਕਰਕੇ ਮੈਂ ਸਾਗ ਨੂੰ ਬਣਾਉਣਾ ਘੱਟ ਹੀ ਪਸੰਦ ਕਰਦੀ ਹਾਂ